ਪੰਜਾਬ ਵਿੱਚ ਖੇਤੀਬਾੜੀ ਸੈਕਟਰ ਦਾ ਕਾਰੋਬਾਰੀ ਵਿਕਾਸ ਵਿੱਚ ਬਹੁਤ ਜ਼ਿਆਦਾ ਰੌਲ ਹੈ ਅਤੇ ਇਹ ਕੀ ਹੈ ਕਿ ਕਾਰੋਬਾਰੀ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਕਿਉਂਕਿ ਪੰਜਾਬ ਵਿੱਚ ਕਈ ਇੱਦਾਂ ਦੀਆਂ ਫ਼ਸਲਾਂ ਹਨ ਜਿਨ੍ਹਾਂ ਦਾ ਕ ਕਾਰੋਬਾਰ ਇੱਧਰ ਹੀ ਨਹੀਂ ਬਾਹਰ ਵੀ ਹੁੰਦਾ ਹੈ ਜਿਨ੍ਹਾਂ ਨੂੰ ਆਪਾਂ ਐਕਸਪੋਟ ਜਾਂ ਇੰਮਪੋਟ ਵੀ ਕਰਦੇ ਹਨ ਜਿਵੇਂ ਕਿ ਟੀ ਕੌਫੀ ਵਗੈਰਾ ਇਹ ਸਾਰੀਆਂ ਚੀਜ਼ਾਂ ਆਪਾਂ ਐਂਕਸਪੋਟ ਜਾਂ ਇੰਮਪੋਟ ਕਰਦੇ ਹਨ ਜਿਹਦੇ ਨਾਲ ਕੀ ਹੈ ਕਿ ਆਪਣੇ ਆਰਥਿਕ ਜਿਹੜੇ ਜੀ ਡੀ ਪੀ ਹੈ ਉਸ ਵਿੱਚ ਕ ਜ਼ਿਆਦਾ ਵਾਧਾ ਹੁੰਦਾ ਹੈ ਅਤੇ ਅਲੱਗ ਤੋਂ ਅਲੱਗ ਜਿਵੇਂ ਕਿ ਮਟੀਰੀਅਲ ਰੋਅ ਮਟੀਰੀਅਲ ਜਿਹੜਾ ਵੀ ਬਣਦਾ ਹੈ ਖੇਤੀਬਾੜੀ ਸੈਕਟਰ ਵਿੱਚ ਉਹ ਸਾਰਾ ਫ਼ੈਕਟਰੀਆਂ ਜਾਂ ਵੱਡੀਆਂ ਇੰਡਸ਼ਟੀਅਲ ਚੀਜ਼ਾਂ ਵਿੱਚ ਯੂਜ਼ ਹੁੰਦਾ ਹੈ ਅਤੇ ਕਈ ਸਾਰੀਆਂ ਚੀਜ਼ਾਂ ਏਦਾਂ ਦੀਆਂ ਹਨ ਜਿਵੇਂ ਜਿਵੇਂ ਕਿ ਰਬੜ੍ਹ ਕਾਡਬੌਡ ਪੇਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੀ ਹੈ ਖੇਤੀਬਾੜੀ ਰੋਅ ਮਟੀਰੀਅਲ ਤੋਂ ਹੀ ਬਣਦੀਆਂ ਹਨ ਅਤੇ ਕੁਝ ਏਦਾਂ ਦੇ ਪੌਦੇ ਹਨ ਜਿਵੇਂ ਕਿ ਮੈਡ ਜਿਨ੍ਹਾਂ ਦੀ ਮੈਡੀਸਨ ਪ੍ਰੋਪਰਟੀ ਹੁੰਦੀ ਆ ਉਹ ਆਪਾਂ ਮੈਡੀਸਨ ਵਿੱਚ ਵੀ ਯੂਜ਼ ਕਰਦੇ ਹਨ ਅਤੇ ਕੁਛ ਏਦਾਂ ਦੇ ਪੌਦੇ ਜਿਹੜੇ ਕਿ ਆਪਾਂ ਆਪਣੇ ਸਪਾਇਸਿਸ ਕੰਟ ਕੰਟਾਮੇਸ਼ਨ ਇਹ ਸਾਰੀਆਂ ਚੀਜ਼ਾਂ ਵਿੱਚ ਵੀ ਯੂਸ ਕਰਦੇ ਹਨ ਅਤੇ ਇਹ ਆਪਣੇ ਕੀ ਆ ਕਿ ਹਰੇਕ ਸੈਕਟਰ ਵਿੱਚ ਖੇਤੀਬਾੜੀ ਦਾ ਕੋਈ ਨਾ ਕੋਈ ਰੌਲ ਆਉਂਦਾ ਹੀ ਹੈ